ਹਾਂਜੀ ਵੀਰ ਜੀ ਕਿੰਨਾ ਕਿਰਾਇਆ ਹੋ ਗਿਆ ਸੱਤਰ ਰੁਪਏ ਅੱਛਾ ਤੇ ਤੁਹਾਡੇ ਕੋਲ ਟੁੱਟੇ ਹੋਣਗੇ ਨਹੀਂ ਮੈਂ ਦੇਖਦੀ ਹਾਂ ਫਿਰ ਅਸਲ ਵਿੱਚ ਮੇਰਾ ਛੋਟਾ ਪਰਸ ਪਤਾ ਨਹੀਂ ਸ਼ਾਇਦ ਮੈਂ ਘਰ ਭੁੱਲ ਗਈ ਹਾਂ ਪਤਾ ਮਿਲ ਨਹੀਂ ਰਿਹਾ ਪਰ ਮੇਰੇ ਕੋਲ ਪੰਜ ਸੌ ਰੁਪਏ ਦਾ ਨੋਟ ਹੈ ਕੀ ਤੁਸੀਂ ਆਸਾਨੀ ਨਾਲ ਤੋੜ ਸਕਦੇ ਹੋ ਉਸ ਨੂੰ ਇੱਕ ਵਾਰ ਚੈੱਕ ਕਰ ਲਓ ਤੁਸੀਂ ਨਹੀਂ ਹੈ ਹੁਣ ਜਾਂ ਐਵੇਂ ਕਰਦੇ ਹਾਂ ਕਿ ਨੇੜੇ ਤੇੜੇ ਜੇ ਕੋਈ ਦੁਕਾਨ ਹੈ ਪਰ ਕੋਈ ਮੈਨੂੰ ਲੱਗਦਾ ਕਿ ਨੇੜੇ ਕੋਈ ਦੁਕਾਨ ਹੀ ਨਹੀਂ ਹੈ ਜਿੱਥੋਂ ਮੈਂ ਪੈਸੇ ਤੁੜਵਾ ਕੇ ਤੁਹਾਨੂੰ ਦੇ ਸਕਾ ਜੇ ਕੋਈ ਏ ਟੀ ਐਮ ਹੁੰਦਾ ਨੇੜੇ ਤਾਂ ਮੈਂ ਉੱਥੋਂ ਪੈਸੇ ਕਢਵਾ ਕੇ ਹੈ ਨਾ ਦੇ ਦਿੰਦੀ ਤੁਸੀਂ ਸੌ ਦਾ ਨੋਟ ਤੋੜ ਸਕਦੇ ਹੋ ਪਰ ਮੇਰੇ ਕੋਲ ਸੌ ਦਾ ਨਹੀਂ ਹੈ ਮੇਰੇ ਕੋਲ ਇੱਕ ਪੰਜਾਹ ਦਾ ਹੈ ਇੱਕ ਪੰਜ ਸੌ ਦਾ ਹੈ ਅਤੇ ਹੁਣ ਆਪਾਂ ਕੀ ਕਰੀਏ ਮੈਂ ਦੇਖਦੀ ਹਾਂ ਕੀ ਕਰ ਸਕਦੇ ਹਾਂ ਜੇ ਜਾਂ ਤਾਂ ਤੁਸੀਂ ਪੰਜਾਹ ਰੁਪਏ ਕੱਟ ਲਓ ਹਾਂ ਜਾਂ ਤਾਂ ਮੇਰੇ ਕੋਲ ਇੱਕ ਆਈਡੀਆ ਹੈ ਕੀ ਤੁਹਾਡੇ ਕੋਲ ਕੁਛ ਗੂਗਲ ਪੇ ਹੈ ਜਾਂ ਯੂ ਪੀ ਆਈ ਆਈ ਡੀ ਹੈ ਮੈਂ ਉਸ ਰਾਹੀਂ ਵੀ ਤੁਹਾਨੂੰ ਭੁਗਤਾਨ ਕਰ ਸਕਦੀ ਹਾਂ ਚੱਲੋ ਹੈ ਗੂਗਲ ਪੇ ਹੈ ਚੱਲੋ ਬਹੁਤ ਵਧੀਆਂ ਗੱਲ ਹੈ ਮੈਂ ਤੁਹਾਨੂੰ ਗੂਗਲ ਪੇ ਰਾਹੀਂ ਹੀ ਭੁਗਤਾਨ ਕਰ ਕਰ ਦੇਵਾਂਗੀ ਚੱਲੋ ਵਧੀਆ ਲਓ ਹਾਂਜੀ ਆ ਗਏ ਤੁਹਾਡੇ ਪੈਸੇ ਆਹ ਵੀਰ ਜੀ ਚੈੱਕ ਕਰ ਲਓ ਅਤੇ ਗੂਗਲ ਪੇ ਰਾਹੀਂ ਤੁਹਾਨੂੰ ਸੱਤਰ ਰੁਪਏ ਤੁਹਾਡਾ ਭੁਗਤਾਨ ਹੋ ਚੁੱਕਿਆ ਆਹ ਮੇਰੇ ਫ਼ੋਨ ਵਿੱਚ ਵੀ ਇੱਕ ਵਾਰ ਚੈੱਕ ਕਰ ਲਓ ਤੁਹਾਡਾ ਧੰਨਵਾਦ ਵੀਰ ਜੀ ਬਹੁਤ ਬਹੁਤ